ਆਧੁਨਿਕ ਸਮੇਂ ਵਿੱਚ ਜੇਕਰ ਦੇਖਿਆ ਜਾਵੇ ਤਾਂ ਅੱਜ ਕੱਲ ਥਰੀ ਡੀ ਪ੍ਰਿੰਟਰਾਂ ਦੀ ਵਰਤੋਂ ਹੋਣ ਲੱਗ ਗਈ ਐ ਜੇ ਕੋਈ ਵੀ ਆਕ੍ਰਿਤੀ ਬਣਾਉਣੀ ਹੋਵੇ ਜਾਂ ਕੋਈ ਸ਼ੇਪ ਇੰਟਰਨੈਟ ਤੋਂ ਦੇਖ ਕੇ ਬਣਾਉਣੀ ਹੋਵੇ ਤਾਂ ਅਸੀਂ ਥਰੀ ਡੀ ਪ੍ਰਿੰਟਰ ਨੂੰ ਕਮਾਂਡ ਦੇ ਦਿੰਨੇ ਆਂ ਤੇ ਉਹ ਉਵੇਂ ਹੀ ਹੂਬਹੂ ਬਣਾ ਕੇ ਚੀਜ਼ ਸਾਨੂੰ ਦੇ ਦਿੰਦਾ ਜਦਕਿ ਪਹਿਲੇ ਸਮੇਂ ਚ ਇਹ ਹੁੰਦਾ ਸੀ ਕਿ ਸਭ ਚੀਜ਼ਾਂ ਹੱਥਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਤੇ ਘੜੀਆਂ ਜਾਂਦੀਆਂ ਸਨ